ਮੇਰੀ ਮਨ ਪਸੰਦ ਗੇਮ ਕ੍ਰਿਕਟ ਹੈ ਔਰ ਇਸ ਕ੍ਰਿਕਟ ਦੀ ਪੋਪੂਲੈਰੀਟੀ ਇੰਡੀਆ ਦੇ ਵਿੱਚ ਬਹੁਤ ਵੱਧ ਚੁੱਕੀ ਹੈ ਜਦੋਂ ਤੋਂ ਇੰਡੀਆ ਦੀਆਂ ਟੀਮਾਂ ਨੇ ਵਰਲਡ ਕੱਪ ਜਿੱਤਿਆ ਹੈ ਪਹਿਲੇ ਫਾਈਵ ਡੇਅ ਮੈਚਿਸ ਹੁੰਦੇ ਸਨ ਜਿਹਦੇ 'ਚ ਪੰਜ ਦਿਨ ਲਗਾਤਾਰ ਕਮੈਂਟਰੀ ਹੀ ਸੁਣਦੇ ਰਹੀਦਾ ਸੀ ਔਰ ਉਸ ਵੇਲੇ ਦੀ ਗੱਲ ਹੈ ਜਦੋਂ ਟੈਲੀਵਿਜ਼ਨ ਤੱਕ ਨਹੀਂ ਸੀ ਹੁੰਦੇ ਹੁਣ ਟੈਲੀਵਿਜ਼ਨ ਹੋਣ ਕਰਕੇ ਜਿਹਦੀ ਲਾਈਵ ਕਮੈਂਟਰੀ ਲਾਈਵ ਬਰੋਡਕਾਸਟ ਔਰ ਲਾਈਵ ਵੀਡੀਓਸ ਅਸੀਂ ਦੇਖ ਸਕਦੇ ਹਾਂ ਔਰ ਲੋਕਾਂ ਦਾ ਇਹਦੇ ਵਿੱਚ ਬਹੁਤ ਇੰਟਰਸਟ ਇਸ ਲਈ ਵੱਧ ਗਿਆ ਹੈ ਔਰ ਇਸ ਦੇ ਵਿੱਚ ਹਰ ਕੋਈ ਇੰਟਰਸਟ ਲੈ ਰਿਹਾ ਹੈ ਇੰਟਰਨੈਸ਼ਨਲ ਫੀਲਡ ਦੇ ਵਿੱਚ ਕ੍ਰਿਕਟ ਦੇ ਵਿੱਚ ਭਾਰਤ ਦਾ ਬੜਾ ਨਾਂ ਹੈ ਔਰ ਇਸਦੇ ਵਿੱਚ ਬਹੁਤ ਅੱਛੇ ਅੱਛੇ ਖਿਲਾੜੀ ਹਨ ਜਿਹਦੇ ਕਰਕੇ ਇਸ ਟੀਮ ਦੇ ਲੋਕ ਜਿਹੜੇ ਨੇ ਵੱਧ ਤੋਂ ਵੱਧ ਕਮਾਈ ਕਰਨ ਦੇ ਵਿੱਚ ਆਪਣਾ ਟਾਈਮ ਪਾਸ ਕਰ ਰਹੇ ਹਨ